ਸਤਿ ਸ਼੍ਰੀ ਅਕਾਲ ਮੈਂ ਪਰਮਜੀਤ ਗੁਰਦਾਸਪੁਰ ਤੋਂ ਹਾਂ ਪਿੰਡ ਵਿੱਚ ਜਾਨਵਰਾਂ ਨੂੰ ਚਰਾਉਣ ਲਈ ਖੁੱਲ੍ਹੀ ਜਗ੍ਹਾ 'ਤੇ ਦਿੱਤਾ ਜਾਂਦਾ ਹੈ ਜਿੱਥੇ ਹਰੀ ਘਾਹ ਹੋਵੇ ਉੱਥੇ ਲੈ ਜਾਂਦੇ ਹਨ ਅਤੇ ਸ਼ਹਿਰਾਂ ਵਿੱਚ ਮੁੱਲ ਦਾ ਚਾਰਾ ਲਿਆ ਲਿਆ ਕੇ ਪਾਉਂਦੇ ਹਾਂ ਆ ਜਾਨਵਰਾਂ ਦਾ ਵੀ ਵੀ ਜਲਵਾ ਵਾਯੂ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਹਾਂ ਵਾਤਾਵਰਨ ਹਾਂ ਹਾਂ ਵਾਤਾਵਰਨ ਬਦਲਦੇ ਰਹਿੰਦੇ ਹਨ ਜਿਵੇਂ ਕਿ ਬਹੁਤ ਜ਼ਿਆਦਾ ਗਰਮੀ ਪੈ ਪੈ ਅਤੇ ਪਸ਼ੂ ਦੁੱਧ ਘੱਟ ਦਿੰਦੇ ਹਨ ਅਤੇ ਬਹੁਤ ਜ਼ਿਆਦਾ ਸਰਦੀ ਪੈਣ ਨਾਲ ਵੀ ਜਾਨਵਰ ਬਿਮਾਰ ਹੋ ਜਾਂਦੇ ਹਨ ਪਾਣੀ ਦੀ ਕਮੀ ਕਮੀ ਨਾਲ ਵੀ ਬ ਬਿਮਾਰ ਪਸ਼ੂ ਬਿਮਾਰ ਹੋ ਜਾਂਦੇ ਹਨ ਅਤੇ ਜਾਨਵਰਾਂ ਦੀ ਬੜੀ ਸਾਂਭ ਸੰਭਾਲ ਮੌਸਮ ਦੇ ਹਿਸਾਬ ਨਾਲ ਕਰਨੀ ਪੈਂਦੀ ਹੈ ਅਤੇ ਪਲਾਸਟਿਕ ਦ ਦੀ ਕੋਈ ਜ ਚੀਜ਼ ਖਾਣ ਨਾਲ ਵੀ ਵ ਜਾਨਵਰ ਬਿਮਾਰ ਹੋ ਜਾਂਦੇ ਹਨ ਧੰਨਵਾਦ ਧੰਨਵਾਦ